ਪੰਜ ਨਵੰਬਰ ਉੱਨੀ ਸੌ ਸੰਤਾਲੀ ਇੱਕ ਅਪ੍ਰੈਲ ਉੱਨੀ ਸੌ ਸੱਤਰ ਬਾਰ੍ਹਾਂ ਅਗਸਤ ਉੱਨੀ ਸੌ ਨੜਿਨਵੇਂ ਦਸ ਸਤੰਬਰ ਉੱਨੀ ਸੌ ਪਚਾਨਵੇਂ ਅਤੇ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ